ਸਾਡੇ ਪਿੰਡਾਂ ਵਿੱਚ ਕਈ ਤਰ੍ਹਾਂ ਦੀਆਂ ਗਰੋਂਡਾਂ ਹੁੰਦੀਆਂ ਹਨ ਜਿਵੇਂ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਕਈਆਂ ਨੂੰ ਪਤਾ ਨਹੀਂ ਹੈ ਪੀ ਗਰੋਂਡ ਵਿੱਚ ਕਈ ਜਾ ਕੀ ਕੀ ਖੇਡਦੇ ਹਨ ਸਾਨੂੰ ਆਪਣੇ ਬੱਚਿਆਂ ਨੂੰ ਗਰੋਂਡ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਜਿਵੇਂ ਉਹਨਾਂ ਨੂੰ ਦੱਸਣਾ ਚਾਹੀਦਾ ਆ ਕਬੱਡੀ ਦੀ ਗਰੋਂਡ ਹੈ ਆਹ ਫੁੱਟਬਾਲ ਦੀ ਗਰਾਉਂਡ ਆ ਕ੍ਰਿਕਟ ਦੀ ਗਰਾਉਂਡ ਹੈ ਅਤੇ ਇਸ ਲੀਏ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਵੀ ਆਹ ਬੰਦਾ ਕਬੱਡੀ ਖੇਡਦਾ ਹੈ ਆਹ ਬੰਦਾ ਫੁੱਟਬਾਲ ਖੇਡਦਾ ਹੈ ਇਸ ਲੀਏ ਸਾਨੂੰ ਇਹ ਜਿਹੜੀਆਂ ਖੇਡਾਂ ਹੈ ਉਸ ਉਹ ਕਾਫੀ ਬੱਚਿਆਂ ਨੂੰ ਚੇਤਾ ਕਰਵਾਉਣੀਆਂ ਚਾਹੀਦੀਆਂ ਹੈ ਵੀ ਪਹਿਲਾਂ ਸਾਡੇ ਬਜ਼ੁਰਗ ਲੋਕ ਆਹ ਖੇਡਾਂ ਖੇਡਦੇ ਸੀ ਇਸ ਲੀਏ ਸਰਕਾਰ ਨੂੰ ਵੀ ਚਾਹੀਦਾ ਹੈ ਪੀ ਜਿਵੇਂ ਕੋਈ ਵੀ ਫੁੱਟਬਾਲ ਦੀ ਗੇਮ ਹੈ ਉਹਨਾਂ ਵਿੱਚ ਕਿੱਟਾਂ ਦਿੱਤੀਆਂ ਜਾਣੀਆਂ ਹਨ ਜਿਵੇਂ ਕਬੱਡੀ ਦੀ ਗੇਮ ਹੈ ਉਹਦੇ ਵਿੱਚ ਵੱਧ ਤੋਂ ਵੱਧ ਇਨਾਮ ਦਿੱਤੇ ਜਾਂਦੇ ਹਨ ਸਾਨੂੰ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਗਰੋਂਡਾਂ ਬਣਾਉਣੀਆਂ ਚਾਹੀਦੀਆਂ ਹਨ ਵਧੀਆ ਸਟੇਡੀਅਮ ਬਣਾਉਣੇ ਚਾਹੀਦੇ ਹਨ ਉਹਨਾਂ ਨੂੰ ਇਨਾਮ ਦਿੱਤਾ ਜਾਵੇ ਉਹਨਾਂ ਦੀ ਹੋਂਸਲਾ ਵਧਾਈ ਦਿੱਤੀ ਜਾਵੇ ਕਿਉਂਕਿ ਸਾਡੇ ਬੱਚੇ ਇਹ ਖੇਡਾਂ ਨੂੰ ਚੇਤਾ ਰੱਖਣ ਕਿ ਇਹ ਖੇਡਾਂ ਸਾਡੇ ਪੰਜਾਬ ਦੀਆਂ ਹਨ ਅਤੇ ਕਈ ਵਾਰੀ ਸਰਕਾਰ ਨੂੰ ਵੱਧ ਤੋਂ ਵੱਧ ਇਨਾਮ ਦੇਣਾ ਚਾਹੀਦਾ ਹੈ ਪੀ ਸਾਡੇ ਬੱਚੇ ਜਿਹੜੇ ਆ ਛੋਟੇ ਬੱਚੇ ਆ ਉਹਨਾਂ ਦੇ ਦਿਲ ਵਿੱਚ ਹੋਵੇ ਵੀ ਅਸੀਂ ਆਹ ਖੇਡ ਖੇਡੀਏ ਅਤੇ ਸਾਨੂੰ ਇਨਾਮ ਜਿੱਤ ਕੇ ਅਸੀਂ ਆਪਣੇ ਘਰ ਜਾਈਏ ਅਤੇ ਆਪਣੇ ਪਿੰਡ ਦਾ ਮਾਣ ਸਭ ਤੋਂ ਵੱਧ ਵਧਾਈਏ ਅਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਅਸੀਂ ਆਹ ਖੇਡਾਂ ਖੇਡ ਕੇ ਆਏ ਸੀ